ਡਾਂਸ ਮੇਰਾ ਪਸੰਦੀਦਾ ਸ਼ੌਕ ਹੈ ਅਤੇ ਮੈਨੂੰ ਡਾਂਸ ਦਾ ਬਹੁਤ ਮਜ਼ਾ ਆਉਂਦਾ ਹੈ ਜਦੋਂ ਮੈਂ ਪੰਜ ਸਾਲ ਦਾ ਸੀ ਅਤੇ ਜਦੋਂ ਮੈਂ ਵੱਡਾ ਹੋਇਆ ਤਾਂ ਮੈਂ ਨੱਚਣਾ ਸ਼ੁਰੂ ਕੀਤਾ ਮੇਰੇ ਮਾਤਾ ਪਿਤਾ ਨੇ ਇਸ ਜਨੂਨ ਨੂੰ ਅੱਗੇ ਵਧਾਉਣ ਲਈ ਮੈਨੂੰ ਡਾਂਸ ਕਲਾਸਾਂ ਵਿੱਚ ਦਾਖਲ ਕਰਵਾਇਆ ਮੈਂ ਡਾਂਸ ਤੋਂ ਬਿਨਾਂ ਇੱਕ ਦਿਨ ਵੀ ਨਹੀਂ ਜਾ ਸਕਦਾ ਮੈਨੂੰ ਡਾਂਸ ਕਰਨਾ ਬਹੁਤ ਪਸੰਦ ਹੈ ਭੰਗੜਾ ਭਾਰਤੀ ਉਪ ਮਹਾਦੀਪ ਦੇ ਪੰਜਾਬ ਖੇਤਰ ਦਾ ਇੱਕ ਪ੍ਰੰਪਰਾਗਤ ਲੋਕ ਨਾਚ ਹੈ ਜੋ ਹੁਣ ਦੁਨੀਆਂ ਭਰ ਦੇ ਮੁਕਾਬਲਿਆਂ ਵਿੱਚ ਪੇਸ਼ ਕੀਤਾ ਜਾਂਦਾ ਹੈ ਜਿੱਥੇ ਭੰਗੜਾ ਮੁਕਾਬਲਿਆਂ ਬਾਰੇ ਵਿਚਾਰ ਕਰਨ ਵਾਲੀ ਵਾਲੀਆਂ ਕੁਝ ਗੱਲਾਂ ਹਨ ਭੰਗੜਾ ਪੰਜਾਬ ਦਾ ਮਸ਼ਹੂਰ ਨਾਚ ਹੈ ਹਰ ਖੁਸ਼ੀ ਦੇ ਮੌਕੇ 'ਤੇ ਭੰਗੜਾ ਜ਼ਰੂਰ ਪਾਇਆ ਜਾਂਦਾ ਹੈ ਪੰਜਾਬ ਅਤੇ ਪੰਜਾਬ ਤੋਂ ਬਾਹਰ ਜਿੱਥੇ ਕਿਤੇ ਵੀ ਪੰਜਾਬੀ ਵਸਦੇ ਹਨ ਇਹ ਕਦੇ ਨਾ ਕਦੇ ਇਹ ਕਦੇ ਨਹੀਂ ਹੋ ਸਕਦਾ ਕਿ ਉਹ ਭੰਗੜਾ ਨਾ ਪਾਉਣ ਪ ਭੰਗੜਾ ਪੰਜਾਬ ਦੇ ਕਿਸਾਨਾਂ ਵੱਲੋਂ ਫਸਲ ਪੱਕਣ ਦੀ ਖੁਸ਼ੀ ਵਿੱਚ ਵਿਸਾਖੀ ਦੇ ਤਿਉਹਾਰ 'ਤੇ ਪਾਇਆ ਜਾਂਦਾ ਹੈ ਭੰਗੜੇ ਵਿੱਚ ਢੋਲ 'ਤੇ ਨੱਚਿਆ ਜਾਂਦਾ ਹੈ ਪੰਜਾਬ ਦਾ ਇਹ ਲੋਕ ਨਾਚ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵੀ ਪ੍ਰਚਲਿਤ ਹੈ ਢੋਲ ਭੰਗੜੇ ਦਾ ਮੁੱਖ ਸਾਜ਼ ਹੈ ਇਸ ਤੋਂ ਬਿਨਾਂ ਹੋਰ ਸਾਜ਼ ਜਿਵੇਂ ਸੱਪ ਕਾਟੋ ਅਲਗੋਜ਼ੇ ਵੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਲੋਕ ਨਾਚ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੀ ਸੋਨ ਸੁਨਹਿਰੀ ਅਤੇ ਰੌਣਕਾਂ ਭਰੀ ਤਸਵੀਰ ਹੈ ਇਹ ਪੰਜਾਬੀ ਲੋਕਾਂ ਦੀ ਸੱਚ 'ਤੇ ਤੁਲਦੀ ਜ਼ੁਬਾਨ ਹਨ ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਮੁਟਿਆਰਾਂ ਦਾ ਸੰਗੀਤ ਦੀ ਭਾਵਨਾ ਦੇ ਖੁੱਲ੍ਹੇ ਦਿਲ ਅਤੇ ਅਨਸ਼ੀਆਸਤ ਵਹਾਅ ਨੂੰ ਬਾਹਰ ਕੱਢਿਆ ਗਿਆ ਹੈ ਜੋ ਲੋਕਾਂ ਨੂੰ ਸ਼ਕਤੀਸ਼ਾਲੀ ਤਰੀਕੇ ਨਾਲ ਭੰਗੜਾ ਪਾਉਣ ਦੀ ਇਜਾਜ਼ਤ ਦਿੰਦਾ ਹੈ ਜਿਸ ਨਾਲ ਬਹੁਤ ਖੁਸ਼ੀ ਮਿਲਦੀ ਹੈ ਅਤੇ ਤਣਾਓ ਘੱਟਦਾ ਹੈ ਭੰਗੜੇ ਦੀਆਂ ਮੁੱਖ ਕਿਸਮਾਂ ਧਮਾਲ ਝੁੰਮਰ ਲੁੱਡੀ ਗਿੱਦਾ ਗੁਟਕਾ ਗੱਤਕਾ ਸੰਮੀ ਅਤੇ ਕਿਕਲੀ ਹਨ ਭੰਗੜਾ ਕਰਦੇ ਹੋਏ ਪ੍ਰੰਪਰਾਗਤ ਆਦਮੀ ਚਾਦਰਾ ਪਹਿਨ ਚਾਦਰਾ ਚਾਦਰਾ ਪਹਿਨਦੇ ਹਨ ਭੰਗੜਾ ਪਾਉਣ ਨਾਲ ਮਨ ਨੂੰ ਖੁਸ਼ੀ ਮਿਲਦੀ ਹੈ ਇਸ ਕਰਕੇ ਪੰਜਾਬ ਵਿੱਚ ਭੰਗੜਾ ਬਹੁਤ ਮਸ਼ਹੂਰ ਹੈ ਮੈਨੂੰ ਵੀ ਭੰਗੜਾ ਪਾਉਣਾ ਪਸੰਦ ਹੈ ਇਸ ਨਾਲ ਮੈਨੂੰ ਮਨ ਵਿੱਚ ਇਸ ਨਾਲ ਮੈਨੂੰ ਖੁਸ਼ੀ ਮਿਲਦੀ ਹੈ